ਪਸ਼ੂਆਂ ਤੋਂ ਫਸਲਾਂ ਦੀ ਰਾਖੀ ਕੱਲੇ ਪਸ਼ੂ ਨਹੀਂ ਪੰਛੀ ਵੀ ਨੁਕਸਾਨ ਕਰਦੇ ਆ ਅਤੇ ਪਸ਼ੂਆਂ ਤੋਂ ਜੇ ਪਸ਼ੂਆਂ ਦੀ ਗੱਲ ਕਰੀਏ ਤਾਂ ਆਮ ਤੌਰ 'ਤੇ ਸਾਡੇ ਜਾਨਵਰ ਜਿਹੜੇ ਆਉਂਦੇ ਆ ਉਹ ਜੰਗਲੀ ਸੂਰ ਗਾਵਾਂ ਮੱਝਾਂ ਅਵਾਰਾ ਪਸ਼ੂ ਹੁੰਦੇ ਜਿਹੜੇ ਅਤੇ ਉਹ ਆਣ ਕੇ ਸਾਡੀ ਫਸਲ ਖਾਂਦੇ ਆ ਤਾਂ ਜਦੋਂ ਫਸਲ ਨੁਕਸਾਨ ਫਸਲ ਦਾ ਹੁੰਦਾ ਅਤੇ ਖਾਣ 'ਤੇ ਵੀ ਨੁਕਸਾਨ ਹੁੰਦਾ ਅਤੇ ਜਿਹੜੇ ਉਹ ਪੈਰਾਂ ਨਾਲ ਮਸਲੀ ਜਾਂਦੀ ਦੱਬੀ ਜਾਂਦੀ ਆ ਇਹਦੇ ਨਾਲ ਵੀ ਨੁਕਸਾਨ ਹੁੰਦਾ ਅਤੇ ਜਦੋਂ ਫਲ 'ਤੇ ਆਈ ਫਸਲ ਖਾਧੀ ਜਾਂਦੀ ਹੈ ਤਾਂ ਫਿਰ ਤਾਂ ਨੁਕਸਾਨ ਜ਼ਿਆਦਾ ਹੁੰਦਾ ਫਿਰ ਉਹਦਾ ਫਲ ਵੀ ਨਹੀਂ ਮਿਲਦਾ ਅਤੇ ਉਸ ਤੋਂ ਬਚਾਅ ਇੱਦਾਂ ਕਰੀਦਾ ਕਿ ਜਿਵੇਂ ਤੇ ਪੰਛੀਆਂ ਪੁੰਛੀਆਂ ਨੂੰ ਵਾਸਤੇ ਅਤੇ ਪਸ਼ੂਆਂ ਵਾਸਤੇ ਇੱਕ ਤਾਂ ਵਿੱਚ ਡਰਨਾ ਖੜਾ ਕੀਤਾ ਜਾਂਦਾ ਪਹਿਰਾਵਾ ਪਾ ਕੇ ਦੂਜਾ ਉਹਨੂੰ ਖੇਤਾਂ ਦੇ ਆਲੇ ਦੁਆਲੇ ਇੱਕ ਵਾੜ ਲਾਈ ਜਾਂਦੀ ਆ ਅਤੇ ਵਾੜ ਲਾ ਕੇ ਕੰਡਿਆਲੀ ਵਾੜ ਉਸ ਤੋਂ ਜੇ ਆਪਣਾ ਫਸਲ ਦੀ ਰਖਵਾਲੀ ਕੀਤੀ ਜਾਂਦੀ ਅਤੇ ਓਹਨੂੰ ਬਚਾਅ ਕੇ ਚਾਰੇ ਪਾਸੇ ਜਿਸ ਦੇ ਨਾਲ ਪਸ਼ੂ ਜਿਹੜੇ ਆ ਵੀ ਮਤਲਬ ਵਿੱਚ ਨਾ ਆਉਣ ਅਤੇ ਜਿਹੜਾ ਡਰਨਾ ਖੜਾ ਹੋਊਗਾ ਉਹਦੇ ਨਾਲ ਪੰਛੀ ਆ ਉਹ ਡਰਨੇ ਤੋਂ ਪੰਛੀ ਇੱਕ ਇੱਕ ਬੰਦੇ ਦੇ ਕੱਪੜਿਆਂ ਦੇ ਤੌਰ ਪਾ ਕੇ ਉਹਨੂੰ ਮਤਲਬ ਡਰਨਾ ਖੜਾ ਕੀਤਾ ਜਾਂਦਾ ਜਿਸ ਤੋਂ ਪੰਛੀ ਡਰ ਜਾਂਦੇ ਆ ਅਤੇ ਆਉਂਦੇ ਨਹੀਂ ਨੁਕਸਾਨ ਨਹੀਂ ਹੁੰਦਾ ਪਸ਼ੂ ਆ ਜਿਹੜੀ ਇਹਨਾਂ ਦਾ ਤਾਂ ਇਹੋ ਹੱਲ ਆ ਕਿ ਜਿਹੜੇ ਆਲੇ ਦੁਆਲੇ ਵਾੜ ਕੀਤੀ ਜਾਂਦੀ ਹੈ ਵਾੜ ਤੋਂ ਵਾੜ ਤੋਂ ਇਹ ਅੰਦਰ ਨਹੀਂ ਲੰਘ ਸਕਦੇ ਉਸ ਤੋਂ ਇਹਨਾਂ ਦਾ ਬਚਾਅ ਹੋ ਜਾਂਦਾ